ਪੋਟਰੇਟ ਕਈ ਤਰ੍ਹਾਂ ਦੇ ਹੁੰਦੇ ਹਨ ਇਹ ਇਸ ਵਿੱਚ ਜਗ੍ਹਾਵਾਂ ਵੀ ਸ਼ਾਮਿਲ ਹੋ ਸਕਦੀਆਂ ਹਨ ਪਹਾੜ ਵੀ ਹੋ ਸਕਦੇ ਹਨ ਕੋਈ ਮਨੁੱਖ ਵੀ ਹੋ ਸਕਦਾ ਹੈ ਕੋਈ ਜਾਨਵਰ ਵੀ ਹੋ ਸਕਦਾ ਹੈ ਅਤੇ ਕੋਈ ਵੀ ਪਸ਼ੂ ਪਕਸ਼ੀ ਸ਼ਾਮਿਲ ਹੋ ਸਕਦਾ ਹੈ ਚਿੱਤਰ ਕਿਸੇ ਵੀ ਚੀਜ਼ ਦਾ ਬਣ ਸਕਦਾ ਹੈ ਅਤੇ ਉਸੇ ਤਰ੍ਹਾਂ ਹੀ ਪੋਟਰੇਟ ਵੀ ਉਸ ਦਾ ਹੀ ਇੱਕ ਛੋਟਾ ਜਿਹਾ ਰੂਪ ਹੁੰਦਾ ਹੈ ਇਹ ਬਹੁਤ ਹੀ ਖਾਸ ਹੁੰਦਾ ਹੈ ਪੋਰਟਰੇਟ ਬਣਾਉਣ ਲਈ ਇੱਕ ਚਿੱਤਰਕਾਰ ਨੂੰ ਬਹੁਤ ਹੀ ਸੂਝ ਬੂਝ ਹੋ ਕੇ ਕੰਮ ਲੈਣਾ ਪੈਂਦਾ ਹੈ ਪੁਰਾਣਿਆਂ ਸਮਿਆਂ ਵਿੱਚ ਰਾਜਾ ਰਾਣੀ ਦੇ ਸਮੇਂ ਵਿੱਚ ਕੈਮਰੇ ਜਾਂ ਤਾਂ ਕੋਈ ਡਿਜੀਟਲ ਚੀਜ਼ਾਂ ਨਹੀਂ ਹੁੰਦੀਆਂ ਸਨ ਅਤੇ ਉਹ ਆਪਣੀ ਯਾਦਗਾਰੀ ਵਿੱਚ ਪੋਟਰੇਟ ਯਾਨੀ ਕਿ ਚਿੱਤਰ ਬਣਵਾਇਆ ਕਰਦੇ ਸੀ ਪੋਟਰੇਟ ਬਣਾਉਣ ਲਈ ਸਭ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਉਹ ਜਿਸ ਚੀਜ਼ ਦਾ ਪੋਰਟਰੇਟ ਬਣਾਉਣਾ ਚਾਹੁੰਦਾ ਹੈ ਉਸ ਦੇ ਅੱਗੇ ਬਿਲਕੁਲ ਸਾਹਮਣੇ ਖੜ੍ਹਾ ਹੋ ਜਾਵੇ ਅਤੇ ਫਿਰ ਉਸ ਦੀਆਂ ਛੋਟੀਆਂ ਛੋਟੀਆਂ ਬਾਰੀਕੀਆਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਚਿੱਤਰ ਨੂੰ ਕੱਢਦਾ ਜਾਵੇ ਪੋਟਰੇਟ ਬਣਾਉਣ ਲਈ ਇੱਕ ਵਿਅਕਤੀ ਨੂੰ ਬਹੁਤ ਹੀ ਸੂਝ ਬੂਝ ਨਾਲ ਕੰਮ ਲੈਣਾ ਚਾਹੀਦਾ ਹੈ ਤਾਂ ਹੀ ਇੱਕ ਪੋਟਰੇਟ ਵਿੱਚ ਜਾਨ ਵਸਦੀ ਹੈ ਉਸ ਨੂੰ ਵੇਖਣ ਵਾਲੇ ਹਰ ਬੰਦੇ ਨੂੰ ਇਹ ਲੱਗਦਾ ਹੈ ਵੀ ਜਿਵੇਂ ਕਿਸੇ ਨੇ ਅਸਲ ਚਿੱਤਰ ਉਸ ਉੱਤੇ ਛਾਪ ਦਿੱਤਾ ਹੋਵੇ ਵੇਖਣ ਵਿੱਚ ਵੀ ਉਹ ਅਸਲੀ ਹੀ ਲੱਗਦਾ ਹੋਵੇ ਅਤੇ ਇਸ ਚੀਜ਼ ਦਾ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੈ ਅਤੇ ਉਸ ਵਿੱਚ ਸਮਾਨਤਾ ਵੀ ਹੋਣੀ ਚਾਹੀਦੀ ਹੈ ਅਤੇ ਉਹ ਯਥਾਰਥਵਾਦ ਵੀ ਇਸੇ ਕਰਕੇ ਹੀ ਸਾਨੂੰ ਸਾਹਮਣੇ ਆਉਂਦਾ ਹੈ